ਹੈਲੋ ਹੈਲੋ ਮੈਡਮ ਤੁਸੀਂ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਹਾਲ ਕਿੱਦਾਂ ਹਾਲ ਚਾਲ ਜੀ ਹਾਂਜੀ ਠੀਕ ਜੀ ਮੈਡਮ ਤੁਸੀਂ ਜੁੱਤੀਆਂ ਵਾਲੀ ਦੁਕਾਨ ਤੋਂ ਬੋਲਦੇ ਹੋ ਮੈਡਮ ਜੀ ਮੈਂ ਆਪਣੇ ਵਾਸਤੇ ਜੁੱਤੀ ਲੈਣੀ ਸੀਗੀ ਮਤਲਬ ਕਿ ਕਿਸ ਤਰ੍ਹਾਂ ਦੀਆਂ ਜੁੱਤੀਆਂ ਹੈਗੀਆਂ ਦੁਕਾਨ 'ਤੇ ਹਾਂਜੀ ਮੈਮ ਅਤੇ ਪੰਜਾਬੀ ਜੁੱਤੀ ਵੀ ਹੈ ਕਢਾਈ ਵਾਲੀ ਜਿ ਜਿਸ ਤਰ੍ਹਾਂ ਹੁਣ 'ਚ ਹੈਗੀ ਚਲਦੀ ਪਈ ਥੋੜ੍ਹੀ ਅਤੇ ਮੀਡੀਅਮ ਹੀਲ ਵਾਲੀ ਜੁੱਤੀ ਹੈਗੀ ਹਾਂ ਹਾਂਜੀ ਅਤੇ ਨਹੀਂ ਗੋਲਡਨ ਕਲਰ ਵਿੱਚ ਹੋਰ ਹੀਲ ਵਾਲੀ ਮੀਡੀਅਮ ਜਿਵੇਂ ਹਾਂਜੀ ਮੈਮ ਮੈਨੂੰ ਮਨਪ੍ਰੀਤ ਨੇ ਦੱਸਿਆ ਸੀ ਕਿ ਤੁਹਾਡੀ ਦੁਕਾਨ ਬਾਰੇ ਅਤੇ ਵਧੀਆ ਜੁੱਤੀ ਉਹ ਲੈ ਕੇ ਆਈ ਸੀ ਨਾ ਤਾਂ ਕਰਕੇ ਉਹ ਦੱਸਦੀ ਪਈ ਸੀ ਕਿ ਭਾਬੀ ਉੱਥੋਂ ਜੁੱਤੀ ਲਿਓ ਹਾਂਜੀ ਹਾਂਜੀ ਹਮ ਅਤੇ ਮੈਮ ਇਹ ਕਿੱਦਾਂ ਮਜ਼ਬੂਤੀ 'ਚ ਕਿੱਦਾਂ ਮਤਲਬ ਚੱਲਣ ਵਾਲੀ ਕਿੱਦਾਂ ਸ ਸਹੀ ਹੈ ਜੀ ਜੀ ਮੈਮ ਠੀਕ ਹੈ ਮੈਮ ਜਦੋਂ ਵੀ ਮੈਂ ਦੁਕਾਨ 'ਤੇ ਆਈ ਉੱਧਰ ਫਿਰ ਮੈਂ ਜੁੱਤੀਆਂ ਦੇ ਦੇਖ ਕੇ ਜਾਊਂਗੀ ਹਾਂਜੀ ਹਾਂਜੀ ਜੀ ਮੈਡਮ ਓਕੇ ਸਤਿ ਸ਼੍ਰੀ ਅਕਾਲ ਜੀ ਓਕੇ